ਖੇਡ ਹੀ ਇੱਕ ਅਜਿਹੀ ਵਿਧੀ ਹੈ ਜਿਸ ਨਾਲ ਕਿ ਵਿਅਕਤੀ ਤੰਦਰੁਸਤ ਰਹਿ ਸਕਦਾ ਹੈ ਪਰ ਸਰਕਾਰ ਖੇਡਾਂ ਪ੍ਰਤੀ ਕੋਈ ਕੁਛ ਵੀ ਪੈਸਾ ਵਗੈਰਾ ਕੁਛ ਵੀ ਨਹੀਂ ਲਗਾ ਰਹੀ ਜਿਸ ਕਰਕੇ ਕਿ ਮਤਲਬ ਜਿਸ ਕਰਕੇ ਕਿ ਵਿਅਕ ਜੋ ਕਿ ਖੇਡਾਂ ਵਾਲੇ ਵਿਅਕਤੀ ਹਨ ਉਹਨਾਂ ਨੂੰ ਉਹਨਾਂ ਦਾ ਟੈਲੈਂਟ ਪਿੱਛੇ ਰਹਿੰਦਾ ਹੈ ਉਹ ਅੱਗੇ ਨਹੀਂ ਆ ਪਾਉਂਦੇ ਜਿਸ ਕਰ ਜਿਸ ਕਰਕੇ ਕਿ ਸਰਕਾਰਾਂ ਖੁਦ ਤਾਂ ਵੋਟਾਂ ਮੰਗਣ ਆ ਜਾਂਦੀਆਂ ਹਨ ਪਰ ਜਦੋਂ ਉਹ ਇੱਕ ਚੰਗਾ ਨੇਤਾ ਬਣ ਜਾਂਦੇ ਹਨ ਉਸ ਤੋਂ ਬਾਅਦ ਉਹ ਪੰਜ ਸਾਲਾਂ ਆਪਣੇ ਉਹਨਾ ਪੰਜ ਸਾਲਾਂ ਵਿੱਚ ਕਿਸੇ ਨੂੰ ਵੀ ਨਹੀਂ ਪੁੱਛਦੇ ਅਗਰ ਉਹ ਇਹਨਾਂ ਪੰਜ ਸਾਲਾਂ ਵਿੱਚ ਹੀ ਇਹ ਪੈਸਾ ਇਹ ਪੈਸਾ ਖੇਡਾਂ ਪ੍ਰ ਖੇਡਾਂ 'ਤੇ ਲਗਾ ਦੇਵੇ ਤਾਂ ਇੱਕ ਬਹੁਤ ਤਾਂ ਇਸ ਕਾ ਇਸ ਨਾਲ ਬਹੁਤ ਹੀ ਖਿਡਾਰੀ ਅੱਗੇ ਆ ਸਕਦੇ ਹਨ ਉਹਨਾਂ ਦਾ ਟੈਲੈਂਟ ਅੱਗੇ ਆ ਸਕਦਾ ਹੈ ਅਤੇ ਆਪਣੇ ਦੇਸ਼ ਨੂੰ ਖੇਡਾਂ ਪ੍ਰਤੀ ਵੀ ਤਰੱਕੀ ਮਿਲ ਮਿਲ ਸਕਦੀ ਹੈ ਇੱਕ ਬਹੁਤ ਵਧੀਆ ਖਿਡਾਰੀ ਮਿਲ ਸਕਦਾ ਹੈ